ਸਥਾਨਾਂ ਦੇ ਨਾਮ ਲੁਧਿਆਣਾ ਅੰਮ੍ਰਿਤਸਰ ਜਲੰਧਰ ਪਟਿਆਲਾ ਬਠਿੰਡਾ ਮੋਹਾਲੀ ਹੁਸ਼ਿਆਰਪੁਰ ਫਿਰੋਜ਼ਪੁਰ ਗੁਰਦਾਸਪੁਰ ਪਠਾਨਕੋਟ ਮਲੇਰਕੋਟਲਾ ਰੂਪਨਗਰ ਅਬੋਹਰ ਮੋਗਾ ਫਰੀਦਕੋਟ ਸ਼ਿਮਲਾ ਮਨਾਲੀ ਜਿਬੀ ਚਾਹਲ ਡਲਹੌਜੀ ਮਕਲੋਡਗੰਜ ਚਿੰਤਪੁਰਨੀ ਨੈਨਾ ਦੇਵੀ ਜੁਆਲਾ ਜੀ ਅਨੰਦਪੁਰ ਸਾਹਿਬ ਦਿੱਲੀ ਲਾਹੌਰ ਬੀਕਾਨੇਰ ਕਸੌਲੀ ਕਸੌਲ ਬਰੋਟ ਵੈਲੀ ਪਾਕਿਸਤਾਨ ਦੁਬਈ ਆਸਟਰੇਲੀਆ ਕੈਨੇਡਾ ਇੰਗਲੈਂਡ ਲੰਡਨ ਸਰੀਂ ਅੰਟਾਰੀਓ